ਸਤਿ ਸ਼੍ਰੀ ਅਕਾਲ ਸਰ ਮੈਂ ਦੇਸਰਾਏ ਬੋਲਦਾ ਹੂੰ ਪਠਾਨਕੋਟ ਦਾ ਰਹਿਣ ਵਾਲਾ ਹੂੰ ਸਰ ਸਾਡੇ ਪੰਜਾਬ ਵਿੱਚ ਫੁਲਕਾਰੀ ਜਨਾਨੀਆਂ ਆਪ ਹੀ ਤਿਆਰ ਕਰਦੀਆਂ ਹਨ ਇਹ ਫੁਲਕਾਰੀ ਜਨਾਨੀਆਂ ਆਪਣੇ ਹੱਥ ਦੀ ਕਰ ਇਸ ਆ ਹੱਥ ਦੀ ਕਾਰੀਗਰੀ ਨਾਲ ਹੀ ਫੁੱਲ ਬੂਟੀਆਂ ਪਾ ਕੇ ਫੁਲਕਾਰੀ ਨੂੰ ਤਿਆਰ ਕਰਦੀਆਂ ਹਨ ਇਹ ਫੁਲਕਾਰੀ ਸਾਡੇ ਪੰਜਾਬ ਵਿੱਚ ਜਨਾਨੀਆਂ ਦੀ ਹੱਥੀਂ ਬਣੀ ਬਹੁਤ ਹੀ ਪਸੰਦ ਹੈ ਇਹ ਫੁਲਕਾਰੀ ਉਦੋੋਂ ਹੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਕੋਈ ਲੜਕੀ ਲੜਕੇ ਦਾ ਵਿਆਹ ਰਚਾਇਆ ਹੋਵੇ ਜਦੋਂ ਮੁੰਡੇ ਜਾਂ ਲੜਕੀ ਨੂੰ ਲੜਕੀ ਨੂੰ ਸ਼ਗਨਾਂ ਦਾ ਕੰਮ ਸ਼ੁਰੂ ਕੀਤਾ ਜਾਵੇ ਫੁਲਕਾਰੀ ਉਹਨਾਂ ਦੇ ਤੇਲ ਚੜ੍ਹਨ ਨਾਲ ਫੁਲਕਾਰੀ ਕੁੜੀ ਜਾਂ ਲੜਕੀ ਦਾ ਸ਼ਗਨ ਕੀਤਾ ਜਾਵੇ ਉਹਨਾਂ 'ਤੇ ਕੀਤੀ ਜਾਂਦੀ ਹੈ ਇਹ ਸਾ ਇਹ ਫੁਲਕਾਰੀ ਸਾਡੇ ਪੰਜਾਬ ਵਿੱਚ ਬਹੁਤ ਹੀ ਮਸ਼ਹੂਰ ਹੈ